ਮੇਰਾ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਅਨੁਭਵ ਕੁਝ ਖਾਸ ਜਿਹਾ ਨਹੀਂ ਰਿਹਾ ਕੁਝ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਜਿਹਨਾਂ ਨੂੰ ਆਪਾਂ ਇੰਗਲਿਸ਼ ਵਿੱਚ ਜਦੋਂ ਅਨੁਵਾਦ ਲੱਭਦੇ ਹਾਂ ਜਾਂ ਆਪਾਂ ਜਦੋਂ ਆਪਾਂ ਗੂਗਲ 'ਚ ਸਰਚ ਕਰਦੇ ਹਾਂ ਜਾਂ ਕਿਸੇ ਵੈਬਸਾਈਟ 'ਤੇ ਲੱਭਦੇ ਹਾਂ ਤਾਂ ਸਾਨੂੰ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ ਆਪਾਂ ਹਿੰਦੀ ਵਿੱਚ ਅਨੁਵਾਦ ਕਰਦੇ ਹਾਂ ਸਾਨੂੰ ਬਹੁਤ ਜਲਦੀ ਉਹਦੇ ਅਰਥ ਮਿਲ ਜਾਂਦੇ ਹਨ ਮੇਰੇ ਕੁਝ ਸ਼ਬਦ ਇਸ ਤਰ੍ਹਾਂ ਦੇ ਸੀ ਜਿਹਦਾ ਆਪਾਂ ਪੰਜਾਬੀ ਵਿੱਚ ਅਨੁਵਾਦ ਕਰਨਾ ਸੀ ਪਰ ਮੈਨੂੰ ਉਸਦੇ ਕੋਈ ਸ਼ਬਦ ਨਹੀਂ ਸੀ ਮਿਲ ਰਹੇ ਉਸਦਾ ਅਨੁਵਾਦ ਕਰਨ ਦਾ ਕੋਈ ਜਾਣਕਾਰੀ ਨਹੀਂ ਸੀ ਮਿਲਦੀ ਇਹਦਾ ਮੇਰੇ ਨਾਲ ਅਨੁਭਵ ਇੰਨਾਂ ਖਾਸ ਨਹੀਂ ਰਿਹਾ ਬਹੁਤ ਸਾਰੀ ਇਸ ਤਰ੍ਹਾਂ ਦੀ ਵਰਡ ਹੁੰਦੇ ਬਹੁਤ ਸ਼ਬਦ ਇਸ ਤਰ੍ਹਾਂ ਦੇ ਆ ਜਿਹਨਾਂ ਦੀ ਜਾਣਕਾਰੀ ਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਬਹੁਤ ਔਖਾ ਲੱਗਦਾ ਵਾ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਅਨੁਭਵ ਖਾਸ ਨਹੀਂ ਹੈ ਕੋ ਕੋਈ ਜਿਵੇਂ ਆਪਾਂ ਇੰਗਲਿਸ਼ ਦੀ ਜਾਣਕਾਰੀ ਹਿੰਦੀ 'ਚ ਅਨੁਵਾਦ ਲੱਭੀਏ ਅਤੇ ਸਾਨੂੰ ਆਸਾਨੀ ਨਾਲ ਮਿਲ ਜਾਂਦੇ ਹਨ ਪੰਜਾਬੀ ਦੇ ਕੁਝ ਸ਼ਬਦ ਇਸ ਤਰ੍ਹਾਂ ਦੇ ਹਨ ਜਿਹਨਾਂ ਦਾ ਅਨੁਵਾਦ ਕਰਨਾ ਬਹੁਤ ਔਖਾ ਲੱਗਦਾ ਹੈ ਇਸ ਦਾ ਅਨੁਭਵ ਖਾਸ ਨਹੀਂ ਰਿਹਾ ਮੇਰਾ ਧੰਨਵਾਦ